ਜੋ ਤੈਰਾਕ ਉੱਚੀ ਥਾਂ ਤੋਂ ਛਾਲ ਮਾਰ ਕੇ ਪਾਣੀ ਵਿੱਚ ਕੁੱਦਦੇ ਹਨ ਉਹ ਪਾਣੀ ਵਿੱਚ ਤੀਹ ਡਿਗਰੀ ਦੇ ਕੋਣ ਤੋਂ ਦਾਖਲ ਹੁੰਦੇ ਨੇ ਜੇਕਰ ਕੋਈ ਪਹਿਲੀ ਵਾਰ ਅਜਿਹਾ ਕਰਦਾ ਤਾਂ ਉਸ ਨੂੰ ਤਲਾਅ 'ਤੇ ਲੱਗੇ ਚਿੰਨ ਅਤੇ ਸਾਵਧਾਨੀ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਰ ਕੇ ਜਾਣਾ ਚਾਹੀਦਾ ਭੱਜਣਾ ਨਹੀਂ ਚਾਹੀਦਾ ਕਿਉਂਕਿ ਗਿੱਲਾ ਹੋਣ ਕਰਕੇ ਤਿਲਕਣ ਹੋ ਜਾਂਦੀ ਹੈ ਅਤੇ ਸੱਟ ਫੇਟ ਲੱਗਣ ਦਾ ਡਰ ਲੱਗਿਆ ਰਹਿੰਦਾ ਸਹਾਰੇ ਲਈ ਲੱਗੇ ਪਾਈਪ ਜੀ ਵਰਤੋਂ ਕਰਨੀ ਚਾਹੀਦੀ ਹੈ ਛਾਲ ਲਗਾਉਣ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਤਲਾਅ ਦੀ ਡੁੰਘਾਈ ਕਿੰਨੀ ਕੁ ਹੈ ਉਨੀ ਕੀ ਛਾਲ ਮਾਰੀ ਚਾਹੀਦੀ ਹੈ ਜਿੰਨੀ ਕੁ ਤੁਸੀਂ ਮਾਰ ਸਕਦੇ ਹੋ ਅਤੇ ਕਿਸੇ ਤਜ਼ਰਬੇਕਾਰ ਕੋਚ ਦੀ ਨਿਗਰਾਨੀ ਹੇਠ ਹੀ ਅਜਿਹੇ ਕੰਮ ਕਰਨੇ ਚਾਹੀਦੇ ਹਨ ਛਾਲ ਮਾਰਨ ਲੱਗਿਆਂ ਸਿਰ ਦਾ ਬਚਾਅ ਕਰਨਾ ਚਾਹੀਦਾ ਹੈ ਸਾਹ ਰੋਕਣ ਦੀ ਕਪੈਸਿਟੀ ਹੋਣੀ ਚਾਹੀਦੀ ਹੈ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ ਸੱਕਸ਼ਨ ਪਾਈਪ ਤੋਂ ਵੀ ਸਾਵਧਾਨੀ ਰੱਖਣੀ ਚਾਹੀਦੀ ਹੈ ਅਤੇ ਬਾਲਾਂ ਨੂੰ ਬੰਨ ਕੇ ਰੱਖਣਾ ਚਾਹੀਦਾ ਸਿਰ 'ਤੇ ਟੋਪੀ ਪਾ ਲੈਣੀ ਚਾਹੀਦੀ ਹੈ ਨੋਜ ਕੈਪ ਵੀ ਲਾਉਣਾ ਚਾਹੀਦਾ ਆ ਨੱਕ ਨੂੰ ਬੰਦ ਰੱਖਣਾ ਚਾਹੀਦਾ ਹੈ